ਹਾਂ ਇੱਕ ਤਸਵੀਰ ਬਹੁਤ ਤਰ੍ਹਾਂ ਦੇ ਸੁਨੇਹੇ ਦੇ ਸਕਦੀ ਹੈ ਫੋਟੋ ਵਿੱਚ ਅਸੀਂ ਖਾਸ ਗੁਣ ਹੁੰਦੇ ਹਨ ਜੋ ਬਿਨਾ ਸ਼ਬਦਾਂ ਦੇ ਗਹਿਰੇ ਸੁਨੇਹੇ ਦੇ ਸਕਦੇ ਹਨ ਜਦੋਂ ਇੱਕ ਚਿੱਤਰ ਖਿੱਚਿਆ ਜਾਂਦਾ ਹੈ ਤਾਂ ਉਸ ਵਿੱਚ ਰਚਨਾ ਰੌਸ਼ਨੀ ਅਤੇ ਵਿਸ਼ੇ ਦੀ ਚੋਣ ਦੀ ਮਦਦ ਨਾਲ ਬਹੁਤ ਕੁਛ ਦਿਖਾਇਆ ਜਾ ਸਕਦਾ ਹੈ ਇੱਕ ਚਿੱਤਰ ਖੁਦ ਵਿੱਚ ਇੱਕ ਕਹਾਣੀ ਬਿਆਨ ਕਰਦਾ ਹੈ ਜਿਸ ਨੂੰ ਅਸੀਂ ਆਪਣੇ ਅਨੁਭਵ ਅਤੇ ਸਮਝ ਦੇ ਆਧਾਰ 'ਤੇ ਸਮਝਦੇ ਹਾਂ ਉਦਾਹਰਣ ਵਜੋਂ ਜੇ ਤੁਸੀਂ ਇੱਕ ਛੋਟੇ ਬੱਚੇ ਦੀ ਤਸਵੀਰ ਵੇਖਦੇ ਹੋ ਜੋ ਗਰੀਬੀ ਦੇ ਜੀਵਨ ਵਿੱਚ ਬੀਤ ਰਿਹਾ ਹੈ ਤਾਂ ਸਿਰਫ ਉਸਦਾ ਦੁਖੀ ਅਤੇ ਬੇਚਾਰਾ ਚਿਹਰਾ ਦੇਖਦੇ ਹੋ ਸਗੋਂ ਸਮਾਜਿਕ ਅਤੇ ਗਰੀਬੀ ਦੇ ਮੁੱਦੇ ਵੀ ਜ਼ਿਹਨ ਵਿੱਚ ਆਉਂਦੇ ਹਨ ਇਸ ਤਰ੍ਹਾਂ ਇੱਕ ਚਿੱਤਰ ਦਿਲਾਂ ਵਿੱਚ ਭਾਵਨਾਵਾਂ ਅਤੇ ਜਵਾਬ ਜਗਾਉਂਦਾ ਹੈ ਜੋ ਕਿ ਸ਼ਬਦਾਂ ਦੇ ਬਿਨਾ ਵੀ ਸਮਝੇ ਜਾ ਸਕਦੇ ਹਨ ਇੱਕ ਹੋਰ ਮਿਸਾਲ ਹੈ ਉਸ ਜਿਸ ਵਿੱਚ ਇੱਕ ਵਿਅਕਤੀ ਟੈਂਕਾਂ ਦੇ ਸਾਹਮਣੇ ਖੜ੍ਹਾ ਹੈ ਜੋ ਚੀਨ ਦੇ ਧਿਆਨਅਮ ਸਵੇਖੇ ਵਿੱਚ ਹੋਈਆਂ ਸੀ ਇਹ ਚਿੱਤਰ ਦਿਖਾਉਂਦਾ ਹੈ ਇੱਕ ਵਿਅਕਤੀ ਕਈ ਆਪਣੇ ਆਜ਼ਾਦੀ ਅਤੇ ਹੱਕਾਂ ਲਈ ਲੜਦਾ ਹੈ ਅਤੇ ਇਹ ਸਾਡੇ ਮਨ ਵਿੱਚ ਸਹਿਮਤੀ ਅਤੇ ਵਿਉਂਤ ਦੇ ਬਾਰੇ ਸੋਚਣ ਨੂੰ ਉਕਸਾਉਂਦਾ ਹੈ ਮੇਰੇ ਕੋਲ ਇੱਕ ਹੋਰ ਕਹਾਣੀ ਹੈ ਜੋ ਮੇਰੇ ਅਨੁਭਵ ਦੇ ਅਕ ਅਨੁਸਾਰ ਹੈ ਇੱਕ ਵਾਰ ਮੈਂ ਇੱਕ ਕਿਸਾਨ ਦੀ ਤਸਵੀਰ ਖਿੱਚੀ ਸੀ ਜਦੋਂ ਕਿਸਾਨ ਆਪਣੇ ਖੇਤ ਵਿੱਚ ਖੜ੍ਹਾ ਹੈ ਜਿਸ ਦੇ ਨਾਲ ਅਧੂਰੇ ਮਿਹਨਤ ਦੇ ਮਸਲੇ ਜੁੜੇ ਹਨ ਇਹ ਚਿੱਤਰ ਖੇਤੀ ਦੀ ਮਹਾਨਤਾ ਅਤੇ ਕਿਸਾਨਾਂ ਦੀ ਮੁਸ਼ਕਲਾਂ ਦੀ ਪਹਿਚਾਣ ਦਿੰਦਾ ਹੈ ਇਹ ਤਸਵੀਰਾਂ ਸਿਰਫ ਇੱਕ ਲਹਿਰ ਦੇ ਇੱਛਾਵਾਂ ਜਾਂ ਸਥਿਤੀਆਂ ਨਹੀਂ ਦਿਖਾਉਂਦੀਆਂ ਸਗੋਂ ਵੱਡੇ ਸਮਾਜਿਕ ਜਾਂ ਮਾਨਵਿਕ ਸੁਨਹਿਰੇ ਨੂੰ ਵੀ ਪ੍ਰਗਟ ਕਰਦੀਆਂ ਹਨ